ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਪੰਜਾਬ ਚਿਕਨ ਸੈਂਟਰ ਗਿੱਦੜਬਾਹਾ ਤੋਂ ਬੋਲ ਰਹੇ ਹੋ ਸਰ ਮੈਂ ਮਲੋਟ ਤੋਂ ਗੱਲ ਕਰ ਰਹੀ ਹਾਂ ਨਿਸ਼ਾ ਸਰ ਤੁਸੀਂ ਉਹ ਕੀ ਕੀ ਮਤਲਬ ਤੁਹਾਡੇ ਮਿਲਦਾ ਹੈ ਮੈਂ ਓਡਰ ਕਰਨਾ ਸੀ ਰੋਸਟਡ ਚਿਕਨ ਬਰਿਆਨੀ ਅਤੇ ਸਰ ਸਰ ਤੁਸੀਂ ਮੈਨੂੰ ਐਕਸਪਲੇਨ ਕਰ ਸਕਦੇ ਹੋ ਕਿ ਮਤਲਬ ਤੁਹਾਡੇ ਹੋਰ ਕੀ ਕੀ ਮਿਲਦਾ ਹੈਗਾ ਗਾ ਇਸ ਤੋਂ ਇਲਾਵਾ ਹਾਂਜੀ ਓਕੇ ਔਰ ਰੋਸਟਡ ਚਿਕਨ ਓਕੇ ਬਿਰਿਆਨੀ ਮਿਲ ਜੇਗੀ ਸਰ ਹਾਂਜੀ ਸਰ ਔਰ ਇੱਕ ਰੋਸਟਡ ਚਿਕਨ ਬਿਰਿਆਨੀ ਅਤੇ ਚਿਕਨ ਚਿੱਲੀ ਅਤੇ ਆਹ ਹੋਰ ਆਪਣੇ ਚਿਕਨ ਦੋ ਕਿੱਲੋ ਇਕੱਲਾ ਚਿਕਨ ਅਲੱਗ ਦੋ ਕਿੱਲੋ ਭੇਜ ਦਿਓ ਬਾਕੀ ਇਹ ਦੋ ਕਿੱਲੋ ਅਲੱਗ ਅਲੱਗ ਭੇਜ ਦਿਓ ਹਾਂਜੀ ਸਰ ਨੇ ਹਾਂਜੀ ਓਕੇ ਔਰ ਸਰ ਉਹ ਕੀ ਕਹਿੰਦੇ ਹੈ ਅ ਮਤਲਬ ਕੀ ਕੀ ਇੰਗ੍ਰੀਡਿਐਂਟਸ ਪੈਣਗੇ ਇਨ੍ਹਾਂ 'ਚ ਤੁਸੀਂ ਮੈਨੂੰ ਚਿਕਨ ਚਿੱਲੀ ਦੇ ਇੰਗ੍ਰੀਡਿਐਂਟਸ ਦੱਸ ਸਕਦੇ ਹੋ ਬਿਰਿਆਨੀ 'ਚ ਬਿਨ ਬਿਰਿਆਨੀ ਦਾ ਕੁਛ ਐਕਸ ਓਕੇ ਯੈੱਸ ਸਰ ਓਕੇ ਔਰ ਇਸ ਤੋਂ ਇਲਾਵਾ ਲੈਕਸ ਮੀ ਐਕਸਪਲੇਨ ਅਦਰਸ ਓਕੇ ਮਤਲਬ ਕੁਛ ਹੋਰ ਮਤਲਬ ਇਸ ਤੋਂ ਇਲਾਵਾ ਕੋਈ ਹੋਰ ਸੌਫਟ ਡਰਿੰਕ ਕੋਕਾ ਕੋਲਾ ਤੋਂ ਇਲਾਵਾ ਕੁਛ ਹੋਰ ਮੰਗਵਾਉਣਾ ਹੋਵੇ ਤੁਸੀਂ ਉਹ ਭੇਜ ਸਕਦੇ ਹੋ ਕੋਈ ਹੋਰ ਓਕੇ ਮਤਲਬ ਕੀ ਕੀ ਮਤਲਬ ਐਗਸ ਦੀ ਰੈਸਿਪੀ 'ਚ ਕੀ ਤੁਸੀਂ ਦੇ ਸਕਦੇ ਹੋ ਹਾਂਜੀ ਓਕੇ ਐੱਗ ਰੋਲ ਮਿਲ ਜੇਗਾ ਸਰ ਐੱਗ ਰੋਲ ਓਕੇ ਅੱਛਾ ਓਕੇ ਸਰ ਸਰ ਫਿਰ ਤੋ ਮਤਲਬ ਅੱਛਾ ਕਾਮ ਚਲਤਾ ਹੋਗਾ ਆਪਕਾ ਕਬ ਤੱਕ ਡਿਲਿਵਰ ਕਰ ਸਕਤੇ ਹੋ ਆਪ ਹਾਂਜੀ ਚੱਲੋ ਸਰ ਜੋ ਮੈਨੇ ਆਪਕੋ ਓਡਰ ਦੀਆ ਹੈ ਨਾ ਆਪ ਤੋ ਵੋ ਫ਼ਿਰ ਆਪ ਦੋ ਦੋ ਕਿੱਲੋ ਭਿਜਵਾ ਦੋ ਓਕੇ ਓਕੇ ਸਰ ਥੈਂਕਿਊ ਸੋ ਮੱਚ ਸਰ ਮੈਂ ਆਪਕੋ ਲੋਕੇਸ਼ਨ ਸੈਂਡ ਕਰ ਦੂੰਗੀ ਆਪ ਭੇਜ ਦੇਨਾ ਓਕੇ ਓਕੇ ਸਰ ਓਕੇ ਥੈਂਕਸ ਥੈਂਕਿਊ ਸਰ